ਹਾਂਜੀ ਇਹ ਸੱਚ ਹੈ ਕਿ ਅਸੀਂ ਪਿੰਡਾਂ ਵਿੱਚ ਰਹਿਣਾ ਪਸੰਦ ਕਰਦੇ ਹਾਂ ਕਿਉਂਕਿ ਪਿੰਡਾਂ ਵਿੱਚ ਲੋਕ ਮੇਲ ਮਿਲਾਪ ਅਤੇ ਇਕੱਠੇ ਰਹਿ ਕੇ ਇਕੱਠੇ ਰਹਿਣਾ ਅਤੇ ਇਕੱਠਾ ਖਾਣਾ ਅਤੇ ਮੇ ਬਹੁਤ ਹੀ ਮੇਲ ਮਿਲਾਪ ਹੁੰਦਾ ਹੈ ਕਿਉਂਕਿ ਜਿਵੇਂ ਕਿ ਆ ਸ਼ਹਿਰਾਂ ਵਿੱਚ ਲੋਕ ਅਲੱਗ ਤਰ੍ਹਾਂ ਦੇ ਬੀਹੇਵ ਕਰਦੇ ਹਨ ਕਿਉਂਕਿ ਉਹ ਆਪਦੇ ਹੀ ਘਰ ਦੇ ਅੰਦਰ ਰਹਿੰਦੇ ਹਨ ਅਤੇ ਲੋਕਾਂ ਨੂੰ ਬੁਲਾਉਣਾ ਵੀ ਆਂਡ ਗੁਆਂਡ ਨਾਲ ਬੁਲਾਉਣਾ ਬੋ ਪਸੰਦ ਨਹੀਂ ਕਰਦੇ ਹਨ ਅਤੇ ਉੱਥੋਂ ਦੀ ਥੋੜ੍ਹੀ ਜਿਹੀ ਕਾਨੂੰਨ ਲਾਗੂੂੂ ਥੋੜ੍ਹੇ ਜਿਹੇ ਲੋਕ ਹਾਂ ਸੁਭਾਅ ਅਲੱਗ ਹੋ ਜਾਂਦਾ ਹੈ ਕਿਉਂਕਿ ਪਿੰਡਾਂ ਵਿੱਚ ਬਹੁਤ ਹੀ ਮੇਲ ਮਿਲਾਪ ਹੁੰਦਾ ਹੈ ਕਿਉਂਕਿ ਉਹ ਰਹਿਣਾ ਬਹੁਤ ਪਸੰਦ ਕਰਦੇ ਹਨ ਕਿਉਂਕਿ ਉਹ ਬਹਾਦਰੀ ਦੇ ਨਾਲ ਹਾਂ ਉਹ ਕਰਦੇ ਹਨ ਅਤੇ ਜਿਵੇਂ ਕਿ ਸ਼ਹਿਰਾਂ ਵਿੱਚ ਹਾਂ ਅਤੇ ਲੋਕ ਘਰਾਂ ਤੋਂ ਬਾਹਰ ਨਹੀਂ ਜਾਂਦੇ ਪਿੰਡਾਂ ਵਿੱਚ ਘਰ ਤੋਂ ਬਾਹਰ ਜਾਂਦੇ ਹਨ ਅਤੇ ਇੱਕ ਦੂਜੇ ਦੇ ਨਾਲ ਬਰਾਬਰ ਬਰਾਬਰ ਖੜ੍ਹੇ ਹੋ ਜਾਂਦੇ ਹਨ ਜਦੋਂ ਵੀ ਕੋਈ ਕੋਈ ਲੜਾਈ ਹੋਵੇ ਕੋਈ ਵੀ ਮਤਲਬ ਕੁਛ ਵੀ ਹੋਵੇ ਤਾਂ ਉਹ ਬਰਾਬਰ ਖੜ੍ਹ ਜਾਂਦੇ ਹਨ ਪਿੰਡਾਂ ਵਿੱਚ ਕਿਉਂਕਿ ਸ਼ਹਿਰ ਵਿੱਚ ਜੇ ਕੋਈ ਇੱਕ ਘਰ ਲੜਦਾ ਹੈ ਤਾਂ ਦੂਜਾ ਘਰ ਨਹੀਂ ਜਾਂਦਾ ਦੇਖਣ ਲਈ ਕਿਉਂਕਿ ਉਹਨਾਂ ਨੂੰ ਐਂ ਹੁੰਦਾ ਵੀ ਇਹ ਕੀ ਹੋ ਸਕਦਾ ਹੈ ਅਤੇ ਇਸ ਲਈ ਪਿੰਡਾਂ ਵਿੱਚ ਰਹਿਣਾ ਪਸੰਦ ਕਰਦੇ ਹਾਂ